ਤੇਰ੍ਹਾਂ ਜਨਵਰੀ ਦੋ ਹਜ਼ਾਰ ਇੱਕੀ ਪੰਜ ਅਕਤੂਬਰ ਦੋ ਹਜ਼ਾਰ ਤਿੰਨ ਨੌ ਅਗਸਤ ਦੋ ਹਜ਼ਾਰ ਚਾਰ ਛੱਬੀ ਜੁਲਾਈ ਉੱਨੀ ਸੌ ਛਿਆਨਵੇਂ ਬਾਰ੍ਹਾਂ ਅਗਸਤ ਦੋ ਹਜ਼ਾਰ ਤਿੰਨ